ਪ੍ਰਤਾਪ ਚੌਂਕ ਗਿੱਲ ਚੌਂਕ ਮੰਜੂ ਸਿਨਮਾ ਸੰਗੀਤ ਸਿਨਮਾ ਰੋਡ ਢੋਲੇਵਾਲ ਚੌਂਕ ਸਮਰਾਲਾ ਚੌਂਕ ਵਰਧਮਾਨ ਚੌਂਕ ਬੀ ਆਰ ਐਸ ਨਗਰ ਮੋਤੀ ਨਗਰ ਸੰਪਤੀ ਸੈਕਟਰ ਛੱਤੀ ਸੈਕਟਰ